ਮੇਰੇ ਕਾਫੀ ਜਿਹੜੇ ਇੱਦਾਂ ਦੇ ਮਨਪਸੰਦ ਗੀਤ ਹੈਗੇ ਨੇ ਜਿਹੜੇ ਮੈਨੂੰ ਅੱਛੇ ਲੱਗਦੇ ਹਨ ਉਹ ਮੈਂ ਕਾਫੀ ਟਾਈਮ ਵਿੱਚ ਅਲੱਗ ਅਲੱਗ ਚੈਨਲਾਂ 'ਤੇ ਸੁਣਦਾ ਅੱਜ ਕਈ ਗਾਣੇ ਇੱਦਾਂ ਨੇ ਜਦੋਂ ਮੈਂ ਥੋੜ੍ਹਾ ਜਿਹਾ ਉਦਾਸ ਹੁੰਦਾ ਔਰ ਉਹ ਸੁਣਦਾ ਹਾਂ ਕਈ ਗਾਣੇ ਇੱਦਾਂ ਨੇ ਜਦੋਂ ਮੈਂ ਖੁਸ਼ ਹੁੰਦਾ ਔਰ ਉਹ ਸੁਣਦਾ ਹਾਂ ਹੁਣ ਜਿੱਦਾਂ ਪੁਰਾਣੇ ਗਾਣਿਆਂ ਦੀ ਗੱਲ ਕਰੀਏ ਤਾਂ ਪੁਰਾਣੇ ਗਾਣੇ ਪੁਰਾਣੇ ਗਾਣਿਆਂ 'ਚ ਇੱਕ ਵੱਖਰੀ ਵਾਈਬ ਆ ਪੁਰਾਣੇ ਗਾਣੇ ਵਿੱਚ ਕੁਛ ਇਹ ਨਹੀਂ ਗਾ ਕਿ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਪਸੰਦ ਛੋਟੇ ਹੁੰਦੇ ਮੈਨੂੰ ਵੀ ਨਹੀਂ ਪਸੰਦ ਸੀ ਪੁਰਾਣੇ ਗਾਣੇ ਪਰ ਅੱਜ ਦੇ ਟਾਈਮ ਵਿੱਚ ਹੁਣ ਸੁਣੋ ਤਾਂ ਪੁਰਾਣੇ ਗਾਣੇ ਕਾਫੀ ਅੱਛੇ ਲੱਗਦੇ ਹਨ ਕਿਸ਼ੋਰ ਕੁਮਾਰ ਨੁਸਰਤ ਫਤਿਹ ਅਲੀ ਖਾਨ ਸੋਨੂੰ ਨਿਗਮ ਹੋ ਗਿਆ ਉਦਿਤ ਨਰਾਇਣ ਹੋ ਗਏ ਕਾਫੀ ਇੱਦਾਂ ਦੇ ਸਿੰਗਰ ਸੀ ਜਿਹੜੇ ਪੁਰਾਣੇ ਗਾਣੇ ਬੋਲਦੇ ਸੀ ਅਤੇ ਕਾਫੀ ਅੱਛੇ ਬੋਲਦੇ ਸੀ ਗਾਣੇ ਅਤੇ ਉਹਨਾਂ ਦੀ ਫਿਲਮਾਂ ਫਿਲਮਾਂ ਦੇ ਗਾਣੇ ਫਿਲਮਾਂ ਵੀ ਇੱਦਾਂ ਦੀਆਂ ਬਣਾਉਂਦੇ ਸਨ ਕਿ ਉਹਨਾਂ ਨੂੰ ਵੇਖ ਕੇ ਉਹਨਾਂ ਵਿੱਚ ਗਾਣੇ ਦਾ ਇੱਕ ਅਲੱਗ ਹੀ ਮਜ਼ਾ ਆਉਂਦਾ ਸੀ ਅੱਜ ਦੇ ਟਾਈਮ ਵਿੱਚ ਉਹ ਚੀਜ਼ ਘੱਟ ਗਈ ਹੈ ਕਿਉਂਕਿ ਅੱਜ ਦੇ ਟਾਈਮ ਦੇ ਲੋਕ ਓਡੋਟੀਨ ਯੂਜ਼ ਕਰਦੇ ਹਨ ਅਤੇ ਬਲਕਿ ਇਹਨਾਂ ਨੂੰ ਲੀਰਿਕਸ ਨਹੀਂ ਚੰਗੀ ਤਰ੍ਹਾਂ ਆਉਂਦੇ ਇੱਕ ਵੱਖਰੇ ਲੀਰਿਕਸ ਲਿਖ ਦਿੰਦੇ ਹਨ ਜੋ ਅੱਜ ਦੀ ਟਾਈਮ ਦੀ ਜਨਰੇਸ਼ਨ ਨੂੰ ਪਸੰਦ ਹੋਣਗੇ ਪਰ ਮੈਨੂੰ ਨਹੀਂ ਪਸੰਦ ਮੈਨੂੰ ਅੱਜ ਵੀ ਉਦਾਂ ਦੇ ਗਾਣੇ ਪਸੰਦ ਹਨ ਹੁਣ ਅਰੀਜੀਤ ਸਿੰਘ ਹੈ ਜਿਸ ਦਾ ਅਰੀਜੀਤ ਸਿੰਘ ਕਾਫੀ ਹੱਦ ਤੱਕ ਉਸ ਵਾਈਬ ਤੱਕ ਗਾਣੇ ਗਾ ਲੈਂਦੇ ਹਨ ਅਰੀਜੀਤ ਸਿੰਘ ਦੇ ਗਾਣੇ ਮੈਨੂੰ ਕਾਫੀ ਅੱਛੇ ਲੱਗਦੇ ਹਨ ਜਿੱਦਾਂ ਅਰੀਜੀਤ ਸਿੰਘ ਸਤਿੰਦਰ ਸਰਤਾਜ ਹੋ ਗਏ ਜਿਹੜੇ ਪੰਜਾਬ ਦੇ ਸਿੰਗਰ ਹਨ ਉਹਨਾਂ ਦੇ ਗਾਣੇ ਜਿਹੜੇ ਸੂਫੀ ਬੋਲਦੇ ਹਨ ਉਹ ਗਾਣੇ ਬਹੁਤ ਅੱਛੇ ਹਨ ਉਹ ਸੁਣ ਕੇ ਤੁਹਾਨੂੰ ਰਿਲੈਕਸ ਹੁੰਦਾ ਉਹ ਤੁਸੀਂ ਹੁਣ ਮੰਨ ਲਓ ਕਿਸੀ ਜਗ੍ਹਾ 'ਤੇ ਜਾ ਰਹੇ ਹੋ ਬੱਸ 'ਚ ਬੈਠੇ ਹੋ ਕਿਤੇ ਟ੍ਰੈਵਲਿੰਗ ਕਰਨਦੇ ਹੋ ਉਹਦੀ ਹੈਡਫੋਨ ਲਾ ਕੇ ਗਾਣੇ ਸੁਣੋਗੇ ਤੁਹਾਨੂੰ ਇੱਕ ਵੱਖਰੀ ਵਾਈਬ ਆਏਗੀ ਕਿ ਗਾਣੇ ਵਿੱਚ ਵਾਈਬਾਂ ਹੀ ਹੈਗੀਆਂ ਗਾਣੇ ਵਿੱਚ ਇੱਕ ਲੀਰਿਕਸ ਹੀ ਹਨ ਇੱਕ ਟਿਊਨ ਹੀ ਹੈ ਜਿਹੜੀ ਤੁਹਾਨੂੰ ਅੱਛੀ ਲੱਗਦੀ ਹੈ ਹੋਰ ਅਤੇ ਸਿੰਗਰਾਂ ਦੀ ਆਵਾਜ਼ ਹੈ ਹੀ ਹੈ ਗਾਣੇ ਇਸ ਕਰਕੇ ਸਾਨੂੰ ਸੁਣਨੇ ਚਾਹੀਦੇ ਹਨ ਕਿਉਂਕਿ ਗਾਣੇ ਸੁਣਨ ਨਾਲ ਸਾਡਾ ਜਿਹੜਾ ਮਨ ਰਿਲੈਕਸ ਕਰਦਾ ਇਸ ਕਰਕੇ ਸਾਨੂੰ ਗਾਣੇ ਕਾਫੀ ਸੁਣਨੇ ਚਾਹੀਦੇ ਆ